ਧਰਮ ਲੋਕਾਂ ਨੂੰ ਇਕੱਠੇ ਰਹਿਣਾ ਸਿਖਾਉਂਦਾ ਹੈ ਧਰਮ ਲੋਕਾਂ ਨੂੰ ਸਿਖਾਉਂਦਾ ਹੈ ਕਿ ਕਿਸੇ ਵੀ ਤਰੀਕੇ ਦਾ ਭੇਦਭਾਵ ਚਾਹੇ ਉਹ ਰੰਗ ਰੂਪ ਨੂੰ ਲੈ ਕੇ ਹੋਵੇ ਜਾਤ ਪਾਤ ਨੂੰ ਲੈ ਕੇ ਹੋਵੇ ਇਹ ਸਭ ਨੂੰ ਮਨੋ ਕੱਢ ਕੇ ਉਸ ਪਰਮਾਤਮਾ ਦੀ ਉਸਤਤ ਕਰਨਾ ਸਾਨੂੰ ਧਰਮ ਸਿਖਾਉਂਦਾ ਹੈ ਧਰਮ ਦੇ ਵਿੱਚ ਕੋਈ ਵੀ ਵੱਡਾ ਛੋਟਾ ਨਹੀਂ ਹੁੰਦਾ ਕਿਸੇ ਦਾ ਵੀ ਕਿਸੇ ਨਾਲੋਂ ਪੱਧਰ ਕਹਿ ਲਓ ਉੱਚਾ ਜਾਂ ਨੀਵਾਂ ਨਹੀਂ ਹੁੰਦਾ ਭਾਈਚਾਰਾ ਜਿਹੜਾ ਹੈ ਅਸੀਂ ਸਾਰੇ ਜਣੇ ਧਾਰਮਿਕ ਤਿਉਹਾਰ ਇ ਇਕੱਠੇ ਮਨਾਉਂਦੇ ਹਾਂ ਜਿਵੇਂ ਕਹਿ ਲਓ ਕਿ ਗੁਰਪੁਰਬ ਜੇ ਅਸੀਂ ਮਨਾਉਂਦੇ ਹਾਂ ਤਾਂ ਸਭ ਤੋਂ ਪਹਿਲਾਂ ਤਾਂ ਸਵੇਰੇ ਸਵੇਰੇ ਪ੍ਰਭਾਤ ਫੇਰੀ ਨਿਕਲਦੀ ਹੈ ਬਾਹਰੀ ਇਸ਼ਨਾਨ ਕਰਕੇ ਫਿਰ ਪਾਲਕੀ ਸਾਹਿਬ ਜਦੋਂ ਨਿਕਲਦੀ ਹੈ ਤਾਂ ਉਹਦੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ ਸਾਰੀ ਸੰਗਤ ਬੜੇ ਹੀ ਪਿਆਰ ਨਾਲ ਜੁੜ ਕੇ ਉਸ ਪਰਮਾਤਮਾ ਦੀ ਉਸਤਤ ਦੇ ਗੀਤ ਗਾਉਂਦੀ ਹੈ ਲੋਕ ਕੀਰਤਨ ਕਰਦੇ ਹਨ ਅਤੇ ਨਾਲ ਨਾਲ ਇੱਕ ਘਰ ਤੋਂ ਦੂਜੇ ਘਰ ਤੱਕ ਜਾਂਦੇ ਹਨ ਜਿੱਥੇ ਵੀ ਪੜਾ ਲੱਗਾ ਹੁੰਦਾ ਹੈ ਫਿਰ ਗੁਰਪੁਰਬ ਦੇ ਵੇਲੇ ਸਾਰੀ ਸੰਗਤ ਜਿਹੜੀ ਹੈ ਹੁੰਮ ਹੁਮਾ ਕੇ ਆਪਣੇ ਕੰਮ ਕਾਰ ਛੱਡ ਕੇ ਉਸ ਗੁਰਪੁਰਬ ਦਾ ਹਿੱਸਾ ਬਣਦੀ ਹੈ ਸੇਵਾ ਦਾ ਵਿੱਚ ਆਪਣਾ ਯੋਗਦਾਨ ਪਾਉਂਦੀ ਹੈ ਮਾਇਆ ਦੇ ਭੇਟਾ ਕਰਦੀ ਹੈ ਅਤੇ ਹੋਰ ਵੀ ਕਈ ਚੜਾਵੇ ਜਿਹੜੇ ਨੇ ਉਹ ਗੁਰਪੁਰਬ ਵਾਲੇ ਦਿਨ ਚੜਾਏ ਜਾਂਦੇ ਹਨ